ਮੈਂ ਚਿੱਤਰਕਾਰੀ ਸੈਂਕਿੰਡ ਕਲਾਸ ਵਿੱਚ ਕਰਨੀ ਸ਼ੁਰੂ ਕੀਤੀ ਸੀ ਸਾਡੇ ਸਕੂਲ ਵਿੱਚ ਇੱਕ ਚਿੱਤਰਕਾਰੀ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਮੈਂ ਪਾਰਟੀਸਪੇਟ ਕੀਤਾ ਉਸ ਦਿਨ ਮੈਂ ਆਪਣੀ ਪਹਿਲੀ ਡਰਾਇੰਗ ਬਣਾਉਣੀ ਸਟਾਰਟ ਕੀਤੀ ਅਤੇ ਉਸ ਨਾਲ ਮੇਰਾ ਉਸ ਡਰਾਇੰਗ ਬਣਾਉਣ ਵਿੱਚ ਇੰਟਰਸ਼ਟ ਵੱਧਦਾ ਜਾ ਵੱਧਦਾ ਗਿਆ ਅਤੇ ਦਿਨ ਪਰ ਦਿਨ ਮੈਂ ਕੋਈ ਵੀ ਫ਼ਰੀ ਟਾਇਮ ਮਿਲਣਾ ਜਾਂ ਕੋਈ ਵੀ ਕੁਛ ਮੈਨੂੰ ਵਧੀਆ ਦਿਖਣਾ ਮੈਂ ਉਸ ਦੀ ਡਰਾਇੰਗ ਕਰਨੀ ਸਟਾਰਟ ਕਰਤੀ ਜਿਸ ਨਾਲ ਮੇਰੀ ਡਰਾਇੰਗ ਕੀ ਹੈ ਹੋਰ ਹੋਰ ਨਿਖਰਦੀ ਗਈ ਅਤੇ ਮੇਰਾ ਇੰਟਰਸ਼ਟ ਹੌਲੀ ਹੌਲੀ ਹੋਰ ਵੱਧਦਾ ਗਿਆ ਡਰਾਇੰਗ ਕਰਦੇ ਕਰਦੇ ਮੈਂ ਕਈ ਨਵੀਆਂ ਚੀਜ਼ਾਂ ਬਣਾਉਣੀਆਂ ਸਟਾਰਟ ਕੀਤੀਆਂ ਅਤੇ ਹੌਲੀ ਹੌਲੀ ਮੇਰਾ ਇਸ ਚੀਜ਼ ਵੱਲ ਨੂੰ ਧਿਆਨ ਹੋਰ ਵੱਧਦਾ ਗਿਆ ਅਤੇ ਮੈਂ ਇਸ ਰਿਲੇਟਡ ਪੜ੍ਹਨਾ ਲਿਖਣਾ ਵੀ ਸ਼ੁਰੂ ਕਰ ਦਿੱਤਾ ਜਿਸ ਨਾਲ ਕੀ ਹੈ ਕਿ ਮੇਰੀ ਦਿਲਚਸਪੀ ਦਿਨ ਪਰ ਦਿਨ ਵੱਧਦੀ ਜਾ ਰਹੀ ਸੀ ਅਤੇ ਇਸ ਨਾਲ ਮੈਂ ਇੱਕ ਫ਼ੇਮਸ ਆਰਟਿਟਸ਼ ਨੂੰ ਫੋਲੋ ਕਰਨਾ ਸਟਾਰਟ ਕੀਤਾ ਰਾਜਾ ਰਵੀ ਵਰਮਾ ਜਿਹੜੇ ਕਿ ਆਪਣੇ ਇੰਡੀਆ ਦੇ ਬਹੁਤ ਬੜੇ ਹੀ ਫ਼ੇਮਸ ਆਰਟਿਸ ਸੀ ਜਿਨ੍ਹਾਂ ਦੀ ਡਰਾਇੰਗ ਮੈਂ ਦੇਖਦੀ ਰਹੀ ਅਤੇ ਉਨ੍ਹਾਂ ਤੋਂ ਹੀ ਮੈਂ ਪ੍ਰਭਾਵਿਤ ਹੋ ਕੇ ਕੁਛ ਨਾ ਕੁਛ ਬਣਾਉਣਾ ਸਟਾਰਟ ਕਰ ਦਿੱਤਾ ਉਨ੍ਹਾਂ ਦੀ ਸਭ ਤੋਂ ਵਧੀਆ ਡਰਾਇੰਗ ਮੈਨੂੰ ਸ਼ਕੁੰਤਲਾ ਲੱਗਦੀ ਹੈ ਜਿਸ ਵਿੱਚ ਉਨ੍ਹਾਂ ਨੇ ਬਹੁਤ ਵਧੀਆ ਹੀ ਸ਼ਕੁੰਤਲਾ ਦੀ ਡਰਾਇੰਗ ਪੇਸ਼ ਕੀਤੀ ਹੈ ਅਤੇ ਇੰਨੇ ਸੋਹਣੇ ਕਲਰ ਉਸ ਵਿੱਚ ਯੂਸ ਕੀਤੇ ਹੋਏ ਨੇ ਮੈਂ ਵੀ ਬਹੁਤ ਸਾਰੇ ਕਲਰ ਯੂਜ਼ ਕਰਦੀ ਹਾਂ ਜਿਵੇਂ ਕਰੇਓਨ ਕਲਰ ਜਾਂ ਫਿਰ ਪੇਂਟਿੰਗ ਵਾਲੇ ਵਾਟਰ ਵਾਲੇ ਕਲਰ ਇਹ ਸਾਰੇ ਕਲਰ ਮੈਂ ਆਪਣੀ ਡਰਾਇੰਗ ਵਿੱਚ ਯੂਜ਼ ਕਰਦੀ ਹਾਂ ਅਤੇ ਆਪਣੀ ਡਰਾਇੰਗ ਨੂੰ ਹੋਰ ਖੂਬਸੂਰਤ ਬਣਾਉਂਦੀ ਹਾਂ